ਹੈਲੋ ਹਾਂਜੀ ਨਮਸਕਾਰ ਮੈਮ ਹਾਂਜੀ ਹਾਂਜੀ ਮੈਮ ਪਠਾਨਕੋਟ ਵਿੱਚ ਤਾਂ ਵੈਸੇ ਮੈਮ ਬਹੁਤ ਸਾਰੀ ਡੇਅਰੀਆਂ ਨੇ ਜੋ ਸਾਡਾ ਇਲਾਕਾ ਮੈਮ ਉੱਥੇ ਤਾਂ ਚਾਰ ਪੰਜ ਡੇਅਰੀਆਂ ਨੇ ਜਿਵੇਂ ਕਿ ਇੱਕ ਹੈਗੀ ਆ ਕਮਲ ਦੀ ਡੇਅਰੀ ਇਥੋਂ ਦੁੱਧ ਵਗੈਰਾ ਬਹੁਤ ਵਧੀਆ ਮਿਲਦਾ ਟਾਈਮਿੰਗ ਵੀ ਇਹਦੀ ਸਵੇਰੇ ਛੇ ਵਜੇ ਓਪਨ ਹੋ ਜਾਂਦੀ ਹੈ ਅਤੇ ਰਾਤ ਨੂੰ ਦੱਸ ਗਿਆਰਾਂ ਵਜੇ ਤੱਕ ਓਪਨ ਹੀ ਰਹਿੰਦੀ ਹੈ ਇਹ ਔਰ ਇੱਥੋਂ ਮੈਮ ਦੁੱਧ ਵੀ ਬਹੁਤ ਵਧੀਆ ਮਿਲਦਾ ਦਹੀਂ ਵਗੈਰਾ ਵੀ ਬਹੁਤ ਵਧੀਆ ਮਿਲਦਾ ਹੋਰ ਵੀ ਮੈਮ ਇੱਕ ਕਮਲ ਦੀ ਸਵੀਟ ਹੈ ਇੱਕ ਮਾਨ ਡੇਅਰੀ ਹੈਗੀ ਹੈ ਹੋਰ ਵੀ ਕਿੰਨੀਆਂ ਸਾਰੀਆਂ ਨੇ ਬਹੁਤ ਵਧੀਆ ਇੱਥੇ ਪ੍ਰੋਵਾਇਡ ਕਰਦੇ ਨੇ ਸਰਵਿਸ ਹਾਂਜੀ